ਹੈਲੋ ਤੁਸੀਂ ਟਰੈਵਲ ਏਜੰਸੀ ਤੋਂ ਗੱਲ ਕਰਦੇ ਹੋ ਜੀ ਮੈਂ ਤੁਹਾਡੀ ਕੈਬ ਬੁੱਕ ਕੀਤੀ ਸੀ ਏਅਰਪੋਰਟ ਜਾਣ ਲਈ ਪਹਿਲਾਂ ਤਾਂ ਤੁਹਾਡਾ ਡਰਾਈਵਰ ਘਰ ਦੇ ਨੇੜੇ ਆਉਣ ਨਹੀਂ ਆ ਰਿਹਾ ਸੀ ਕਹਿੰਦਾ ਕਿ ਮੈਂ ਉਰੇ ਨਹੀਂ ਆਵਾਂਗਾ ਜਿਵੇਂ ਕਿ ਮੈਂ ਏਅਰਪੋਰਟ ਜਾਣਾ ਸੀ ਮੇਰੇ ਦੋ ਤਿੰਨ ਬੈਗ ਸੀ ਮੈਂ ਸਾਰੇ ਬੈਗ ਚੱਕ ਕੇ ਚੌਂਕ ਤੱਕ ਨਹੀਂ ਆ ਸਕਦਾ ਸੀਗਾ ਤਦੀ ਮੈਂ ਡਰਾਈਵਰ ਨੂੰ ਬੋਲ ਰਿਹਾ ਸੀਗਾ ਕਿ ਉੱਥੇ ਆਵੇ ਮਗਰ ਤੁਹਾਡੇ ਡਰਾਈਵਰ ਨੇ ਕੋਈ ਗੱਲ ਨਹੀਂ ਸੁਣੀ ਉਹਨੇ ਕਿਹਾ ਕਿ ਤੁਹਾਨੂੰ ਉਰੇ ਹੀ ਆਉਣਾ ਪੈਣਾ ਫਿਰ ਮੈਂ ਔਖਾ ਸੌਖਾ ਹੋ ਕੇ ਸਾਰੇ ਬੈਗ ਚੱਕ ਕੇ ਚੌਂਕ ਤੱਕ ਪਹੁੰਚਿਆ ਬੈਗ ਰੱਖੇ ਤਾਂ ਫਿਰ ਜਦ ਅਸੀਂ ਅੱਗੇ ਚੱਲੇ ਤਾਂ ਫਿਰ ਅੱਗੇ ਜਾ ਕੇ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤਾਂ ਮੈਂ ਉਹਨੂੰ ਕਿਹਾ ਕਿ ਛੇਤੀ ਚੇਂਜ ਕਰ ਤਾਂ ਉਹਨੇ ਵੀ ਉਹ ਚੀਜ਼ ਉਹ ਚੀਜ਼ ਕਰਨ ਲਈ ਬਹੁਤ ਸਮਾਂ ਲਾ ਦਿੱਤਾ ਹੈ ਜਿਸ ਕਰਕੇ ਇਹ ਚੀਜ਼ਾਂ ਦੌਰਾਨ ਕਰਕੇ ਅੱਗੇ ਟਰੈਫਿਕ ਵੀ ਮੈਨੂੰ ਬਹੁਤ ਮਿਲੀ ਟਰੈਫਿਕ ਮਿਲਣ ਕਰਨ ਮੇਰੇ ਏਅਰਪੋਰਟ 'ਤੇ ਮੈਂ ਪਹੁੰਚਿਆ ਤਾਂ ਮੇਰੀ ਫਲਾਈਟ ਡਿਲੇਅ ਹੋ ਚੁੱਕੀ ਸੀ ਜਿਸ ਕਰਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਡਰਾਈਵਰ 'ਤੇ ਵੀ ਬਹੁਤ ਬੋਲਿਆ ਕਿ ਮੈਂ ਤੈਨੂੰ ਪੈਸੇ ਨਹੀਂ ਦੇਵਾਂਗਾ ਤੇਰੀ ਗਲਤੀ ਸੀਗੀ ਜੇ ਤੂੰ ਟਾਈਮ 'ਤੇ ਪਹੁੰਚ ਜਾਂਦਾ ਮੇਰੇ ਕੋਲ ਮੈਂ ਆਪਣੇ ਬੈਗ ਰੱਖ ਦਿੰਦਾ ਤਾਂ ਮੈਂ ਟਾਈਮਲੀ ਪਹੁੰਚ ਜਾਂਦਾ ਆਪਣੇ ਏਅਰਪੋਰਟ 'ਤੇ ਮੈਂ ਆਪਣੀ ਫਲਾਈਟ ਲੈ ਜਾ ਸਕਦਾ ਸੀਗਾ ਬਟ ਹੁਣ ਉਨ ਉਸੀ ਉਸੀ ਵਜ੍ਹਾ ਕਾਰਨ ਮੈਂ ਨਾ ਫਲਾਈਟ 'ਤੇ ਜਾ ਸਕਿਆ ਮੇਰਾ ਕੰਮ ਵਿੱਚ ਰਹਿ ਗਿਆ ਨਾ ਮੈਂ ਤੁਹਾਨੂੰ ਮੈਂ ਚਾਹੁੰਦਾ ਕਿ ਮੇਰੇ ਪੈਸੇ ਰਿਫੰਡ ਕਰਨ ਜਾਣ ਜਾਂ ਤਾਂ ਉਸ ਟਰੈਵਰ 'ਤੇ ਕੰਪਲੇਂਟ ਕੀਤੀ ਜਾਵੇ